ਸਤਿ ਸ਼੍ਰੀ ਅਕਾਲ ਮੈਂ ਅਮਨਪ੍ਰੀਤ ਕੌਰ ਪਠਾਨਕੋਟ ਤੋਂ ਗੱਲ ਕਰਦੀ ਪਈ ਹਾਂ ਜਿਵੇਂ ਕਿ ਸਾਡੇ ਭਾਈਚਾਰੇ ਵਿੱਚ ਕਾਫ਼ੀ ਪੰਜਾਬ ਦੇ ਜਿਹੜੇ ਪ੍ਰਸਿੱਧ ਜਿਹੜੇ ਭਾਈਚਾਰਕ ਸਮਾਗਮ ਆ ਉਹਨਾਂ ਵਿੱਚ ਲੋਹੜੀ ਵਿਸਾਖੀ ਗੁਰਪੁਰਬ ਕੋਈ ਰਾਮਲੀਲਾ ਵਗੈਰਾ ਕੁਛ ਵੀ ਹੈ ਅਤੇ ਉਹਨਾਂ ਵਿੱਚ ਜਿਹੜਾ ਭਾਈਚਾਰੇ ਸਾਰਾ ਇਕੱਠਾ ਹੁੰਦਾ ਵਾ ਸਾਰੇ ਇਕੱਠੇ ਹੋ ਕੇ ਜਿਹੜਾ ਉਹ ਪਾਰਟੀਆਂ ਤਿਉਹਾਰ ਜਿਹੜਾ ਵਾ ਉਹ ਮਨਾਉਂਦੇ ਹਨ ਅਤੇ ਮਸਤੀ ਕਰਦੇ ਹਨ ਅਤੇ ਸਾਡੇ ਜਿਹੜੇ ਮਤਲਬ ਵਿਸਾਖੀ ਜਦੋਂ ਵਿਸਾਖੀ ਉਦੋਂ ਮਨਾਉਂਦੇ ਜਦੋਂ ਕਿ ਕਣਕਾਂ ਦੀ ਵਾਢੀ ਹੁੰਦੀ ਆ ਸਾਰੇ ਜਿਹੜੇ ਕਿਸਾਨ ਕੱਠ ਕਿਸਾਨ ਇੱਕ ਮੇਲਾ ਕਰਦੇ ਆ ਭੰਗੜਾ ਪਾਉਂਦੇ ਹਨ ਅਤੇ ਮੇਲਾ ਵੀ ਲੱਗਦਾ ਵਾ ਵਿਸਾਖੀ ਦਾ ਜਿਹਦੇ 'ਚ ਸਾਰੇ ਬੱਚੇ ਬਜ਼ੁਰਗ ਨੌਜਵਾਨ ਸਭ ਜਾਂਦੇ ਆ ਮੇਲੇ ਉੱਤੇ ਸਭ ਉੱਥੇ ਨੱਚਦੇ ਆਪਣੀ ਮਸਤੀ ਕਰਦੇ ਹਨ ਪਾਰਟੀ ਮਨਾਉਂਦੇ ਹਨ ਖਾਂਦੇ ਪੀਂਦੇ ਵਧੀਆ ਕੱਪੜੇ ਪਾ ਕੇ ਅਤੇ ਵਿਸਾਖੀ ਦਾ ਮੇਲਾ ਇੱਕ ਭਾਈਚਾਰਕ ਸਮਾਗਮ ਆ ਫਿਰ ਗੁਰਪੁਰਬ ਭਾਈਚਾਰਕ ਉਹ 'ਚ ਵੀ ਉਹ ਵੀ ਇੱਕ ਭਾਈਚਾਰਕ ਸਮਾਗਮ ਆ ਉਹ 'ਚ ਵੀ ਸਾਰੇ ਲੋਕ ਇਕੱਠੇ ਹੁੰਦੇ ਹਨ ਅਤੇ ਗੁਰੂ ਗੁਰਪੁਰਬ ਮਨਾਉਂਦੇ ਹਨ ਗੁਰੂਦੁਆਰੇ ਮੱਥਾ ਟੇਕਦੇ ਹਨ ਅਤੇ ਲੋਹੜੀ ਦਾ ਸਮਾਗਮ ਆ ਲੋਹੜੀ ਉੱਤੇ ਰਾਤ ਨੂੰ ਸਾਰੇ ਲੋਕ ਲੋਹੜੀ ਬਾਲਕੇ ਉਹਨਾਂ ਦੇ ਆਲੇ ਦੁਆਲੇ ਮੂੰਗਫਲੀ ਵਿੱਚ ਰਿਉੜੀਆਂ ਵਗੈਰਾ ਸੁੱਟਦੇ ਹਨ ਅਤੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਜਿਹੜਾ ਲੋਹੜੀ ਦਾ ਤਿਉਹਾਰ ਹੈ ਉਹ ਵੀ ਉਹ ਭਾ ਉਹ ਪੰਜਾਬ ਦੇ ਪੰਜਾਬ ਦੇ ਵਿੱਚ ਉਹ ਕਾਫ਼ੀ ਜ਼ਿਆਦਾ ਮਤਲਬ ਕਿ ਲੋਕਪ੍ਰਿਯਾ ਅਤੇ ਲੋਕ ਪੰਜਾਬ ਵਿਚ ਪੰਜਾਬੀ ਲੋਕ ਲੋਹੜੀ ਦਾ ਤਿਉਹਾਰ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਨਾਲ ਅਤੇ ਮਸਤੀ ਦੇ ਨਾਲ ਮਨਾਉਂਦੇ ਹਨ ਅਤੇ ਰਾਮ ਲੀਲਾ ਫਿਰ ਹੁੰਦੀ ਆ ਦੁਸਹਿਰਾ ਦੀ ਰਾਮ ਲੀਲਾ ਦੁਸਹਿਰਾ ਤੋਂ ਦਸ ਦਿਨ ਪਹਿਲਾਂ ਰਾਮ ਲੀਲਾ ਹੁੰਦੀ ਆ ਰਾਮ ਲੀਲਾ ਵਿੱਚ ਸਾਰੇ ਲੋਕ ਜਿਹੜੇ ਆ ਰਾਤ ਨੂੰ ਇਕੱਠੇ ਹੋ ਕੇ ਵੇਖਦੇ ਹਨ ਜਿਸ ਤਰ੍ਹਾਂ ਨਾਟਕ ਕਰਦੇ ਜਿਹੜਾ ਰਾਮ ਲੀਲਾ ਦਾ ਹੁੰਦਾ ਉਹ ਦੇਖਦੇ ਹਨ ਫਿਰ ਉਸ ਤੋਂ ਬਾਅਦ ਦੁਸਹਿਰਾ ਦੁਸਹਿਰੇ ਉੱਤੇ ਵੀ ਸਾਰੇ ਲੋਕ ਇਕੱਠੇ ਹੋ ਕੇ ਦੁਸਹਿਰਾ ਵੀ ਮਨਾਉਂਦੇ ਹਨ ਪੰਜਾਬ ਵਿੱਚ ਕਾਫ਼ੀ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਜਿੰਨਾ ਵਿੱਚ ਮਤਲਬ ਕਿ ਇਹ ਜਿਹੜੇ ਸਾਰੇ ਤਿਉਹਾਰ ਇਹ ਇੱਥੇ ਮੁੱਖ ਤਿਉਹਾਰ ਹਨ ਕਿ ਦਿਵਾਲੀ ਤਿਉਹਾਰ ਆ ਉਹ ਵੀ ਕਾਫ਼ੀ ਮੁੱਖ ਤਿਉਹਾਰ ਉਹ ਵੀ ਇੱਕ ਸਮਾਗਮ ਹੈ ਫਿਰ ਵੀ ਸਾਰੇ ਲੋਕ ਇਕੱਠੇ ਹੁੰਦੇ ਹਨ ਦੁਸਹਿਰੇ ਦਾ ਮੇਲਾ ਲੱਗਦਾ ਹੈ ਉਹ ਵੀ ਇੱਕ ਭਾਈਚਾਰੇ ਦਾ ਇਕ ਜਿਹੜਾ ਸਮਾਗਮ ਹੀ ਹੈ ਕਿ ਜਿਹੜਾ ਭਾਈਚਾਰਾ ਇਕੱਠਾ ਹੋ ਕੇ ਵਿਚ ਉਹਨਾਂ ਦੀ ਕੋਈ ਕੋਈ ਜਾਤ ਧਰਮ ਨਹੀਂ ਹਰ ਇੱਕ ਜਿਹੜਾ ਜਾਤ ਧਰਮ ਦੇ ਲੋਕ ਉਹ ਸਾਰੇ ਮਿਲ ਕੇ ਅਤੇ ਉਸ ਉਸ ਮਤਲਬ ਕਿ ਪਾਰਟੀ ਨੂੰ ਉਸ ਤਿਉਹਾਰ ਨੂੰ ਮਨਾਉਂਦੇ ਹਨ